ਭੰਗੜਾ ਐਰੋਵੈਕਸ ਨੂੰ ਇੱਕ ਮਜੇਦਾਰ ਅਤੇ ਗਤੀਸ਼ੀਲ ਕਸਰਤ ਅਨੁਭਵ ਬਣਾਉਣ ਵਿੱਚ ਸੰਗੀਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਦੇ ਮੂਲ ਰੂਪ ਵਿੱਚ ਭੰਗੜਾ ਐਰੋਵਿਕਸ ਰਵਾਇਤੀ ਪੰਜਾਬੀ ਭੰਗੜਾ ਡਾਂਸ ਦੇ ਊਰਜਾਵਾਨ ਤਾਲ ਵੱਧ ਤੱਤਾਂ ਨੂੰ ਐਰੋਵਿਕ ਕਸਰਤ ਨਾਲ ਮਿਲਾਉਂਦਾ ਹੈ ਅਤੇ ਸੰਗੀਤ ਇਸ ਫਿਊਜ਼ਨ ਲਈ ਕੇਂਦਰੀ ਹੈ ਇਸ ਸ਼ੈਲੀ ਵਿੱਚ ਆਮ ਤੌਰ ਤੇ ਉੱਚ ਟੈਂਪੋ ਟਰੈਕਾਂ ਨੂੰ ਪ੍ਰਾਪਗਤ ਯੰਤਰਾਂ ਦੁਆਰਾ ਬਣਾਇਆ ਗਿਆ ਹੈ ਜਿਵੇਂ ਕੀ ਢੋਲ ਇੱਕ ਵੱਡਾ ਡਰੱਮ ਜੋ ਇੱਕ ਸ਼ਕਤੀਸ਼ਾਲੀ ਡਰਾਈਵਿੰਗ ਲੈ ਪ੍ਰਦਾਨ ਕਰਦਾ ਹੈ ਤੁੰਬੀ ਇੱਕ ਸਿੰਗਲ ਤਾਰ ਵਾਲਾ ਸਾਜ ਜੋ ਇੱਕ ਵਿਲੱਖਣ ਸੁਰੀਲੀ ਲੈਨ ਜੋੜਦਾ ਹੈ ਅਤੇ ਕਈ ਹੋਰ ਪਰਕਸਿਵ ਤੱਤ ਜਿਵੇਂ ਚਿਮਟਾ ਅਤੇ ਢੋਲਕੀ ਇਹ ਸੰਗੀਤਕ ਭਾਗ ਇੱਕ ਉਤਸਾਹੀ ਅਤੇ ਜਸ਼ਨ ਦਾ ਮਾਹੌਲ ਬਣਾਉਂਦੇ ਹਨ ਜੋ ਨਾ ਸਿਰਫ ਸਰੀਰਿਕ ਕਸਰਤ ਨੂੰ ਵਧਾਉਂਦਾ ਹੈ ਬਲਕੀ ਭਾਗੀਦਾਰਾਂ ਦੇ ਮੂਡ ਅਤੇ ਪ੍ਰੇਰਨਾ ਨੂੰ ਵੀ ਉੱਚਾ ਕਰਦਾ ਹੈ ਸੰਗੀਤ ਦੀ ਤਾਲ ਵੱਧ ਅਤੇ ਸੁਰੀਲੀ ਬਨਤਰ ਕਸਰਤ ਲਈ ਗਤੀ ਨਿਰਧਾਰਤ ਕਰਨ ਵਿੱਚ ਮਦਦ ਕਰਦੀ ਹੈ ਵੱਖ ਵੱਖ ਡਾਂਸ ਸਟੈਪਸ ਅਤੇ ਐਰੋਵਿਕ ਅੰਦੋਲਨਾਂ ਰਾਹੀਂ ਭਾਗ ਲੈਣ ਵਾਲਿਆਂ ਨੂੰ ਮਾਰਗਦਰਸ਼ਨ ਕਰਦੀ ਹੈ ਜੀਵੰਤ ਅਤੇ ਸੱਭਿਆਚਾਰਕ ਤੌਰ ਤੇ ਅਮੀਰ ਸੰਗੀਤ ਦਾ ਇਹ ਏਕੀਕਰਨ ਕਸਰਤ ਦੀ ਰੂਟੀਨ ਨੂੰ ਇੱਕ ਜੀਵੰਤ ਡਾਂਸ ਨਾਲ ਭਰੇ ਅਨੁਭਵ ਵਿੱਚ ਬਦਲਦਾ ਹੈ ਇਸ ਨੂੰ ਵਧੇਰੇ ਆ ਆਕਰਸ਼ਕ ਅਤੇ ਘੱਟ ਇਕਸਾਰ ਬਣਾਉਂਦਾ ਹੈ ਇਸ ਤੋਂ ਇਲਾਵਾ ਸੰਗੀਤ ਅਕਸਰ ਰਵਾਇਤੀ ਪੰਜਾਬੀ ਗੀਤਾਂ ਜਾਂ ਭੰਗੜੇ ਦੇ ਪ੍ਰਭਾਵਾਂ ਦੇ ਨਾਲ ਆਧੁਨਿਕ ਰੂਪਾਂਤਰਾਂ ਨੂੰ ਸ਼ਾਮਲ ਕਰਦਾ ਹੈ